ਪੰਜਾਬ ਵਿੱਚ ਸਭਿਆਚਾਰਕ ਤਿਉਹਾਰ ਲੋਹੜੀ ਦਿਵਾਲੀ ਰੱਖੜੀ ਦੁਸਹਿਰਾ ਬਤੰ ਬਸੰਤ ਪੰਚਮੀ ਵਿਸਾਖੀ ਆਦਿ ਨੂੰ ਮੰਨਿਆ ਜਾਂਦਾ ਹੈ ਅਤੇ ਇਹ ਬਹੁਤ ਹੀ ਬੜੀ ਧੂਮ ਧਾਮ ਨਾਲ ਮਨਾਏ ਜਾਂਦੇ ਹਨ ਦਿਵਾਲੀ ਵਾਲੇ ਦਿਨ ਲੋਕ ਮੱਥਾ ਟੇਕਦੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਆਪਣੇ ਘਰਾਂ ਵਿੱਚ ਬਣਾਉਂਦੇ ਹਨ ਰੱਖੜੀ ਵਾਲੇ ਦਿਨ ਇੱਕ ਭੈਣ ਆਪਣੇ ਭਰਾ ਦੇ ਰੱਖਣੀ ਬੰਨਦੀ ਹੈ ਲੋਹੜੀ ਵਾਲੇ ਦਿਨ ਰਾਤ ਨੂੰ ਬਹੁਤ ਸਾਰੀ ਲੱਕੜਾਂ ਨਾਲ ਅੱਗ ਲਾ ਕੇ ਉਸਦੇ ਆਲੇ ਦੁਆਲੇ ਪਰਿਵਾਰ ਦੇ ਮੈਂਬਰ ਬੈਠ ਕੇ ਲੋਹੜੀ ਸੇਕਦੇ ਹਨ ਅਤੇ ਵਿਸਾਖੀ ਵਾਲੇ ਦਿਨ ਵਿਸਾਖੀ ਦੇ ਬਹੁਤ ਸਾਰੇ ਮੇਲੇ ਲੱਗਦੇ ਹਨ ਬਸੰਤ ਪੰਚਮੀ ਨੂੰ ਜਵਾਕ ਕੋਠਿਆਂ 'ਤੇ ਚੜ੍ਹ ਕੇ ਪਤੰਗ ਉਡਾਉਂਦੇ ਹਨ ਅਤੇ ਅਪ ਆਨੰਦ ਮਾਣਦੇ ਹਨ